ਵੈਸੇ ਤਾਂ ਮੈਂ ਨਗਦ ਅਤੇ ਔਨਲਾਈਨ ਵੀ ਪੇਮੈਂਟ ਕਰਦਾ ਰਹਿੰਦਾ ਪਰ ਅੱਜ ਕੱਲ੍ਹ ਜ਼ਿਆਦਾ ਔਨਲਾਈਨ ਪੇਮੈਂਟ ਹੀ ਹੁੰਦੀ ਹੈ ਅਤੇ ਮੈਂ ਵੀ ਜ਼ਿਆਦਾ ਔਨਲਾਈਨ ਹੀ ਪੇਮੈਂਟ ਕਰਦਾ ਹਾਂ ਪਰ ਜਿਹੜੀਆਂ ਸਾਡੇ ਪਿੰਡ ਵਿੱਚ ਦੁਕਾਨਾਂ ਨੇ ਪਰਚੂਨ ਦੀਆਂ ਉਹਨਾਂ 'ਤੇ ਤਾਂ ਨਗਦੀ ਭੁਗਤਾਨ ਹੁੰਦਾ ਕਿਉਂਕਿ ਉਹਨਾਂ ਕੋਲ ਔਨਲਾਈਨ ਪੇਮੈਂਟ ਨਹੀਂ ਨਾ ਹਾਲੇ ਚਲਾਈ ਨਹੀਂ ਉਹਨਾਂ ਨੇ ਉਂਝ ਵੀ ਚਲਾਉਂਦੇ ਵੀ ਨਹੀਂ ਹੈਗੇ ਡਰਦੇ ਵੀ ਨੇ ਪਿੰਡਾਂ ਦੇ ਲੋਕ ਅਤੇ ਉਹਨਾਂ ਉੱਪਰ ਫਿਰ ਔਨਲਾਈਨ ਪੇਮੈਂਟ ਨਹੀਂ ਹੁੰਦੀ ਅਤੇ ਕੈਸ਼ ਹੀ ਲੈਂਦੇ ਨੇ ਉਹ ਨਗਦ ਭੁਗਤਾਨ ਅਤੇ ਬਾਜ਼ਾਰ ਵਿੱਚ ਵੀ ਕੁਝ ਦੁਕਾਨਾਂ ਨੇ ਜਿਨ੍ਹਾਂ 'ਤੇ ਹਜੇ ਨਗਦੀ ਭੁਗਤਾਨ ਹੁੰਦਾ ਉਹਨਾਂ 'ਤੇ ਵੀ ਔਨਲਾਈਨ ਨਹੀਂ ਪੇਮੈਂਟ ਹੁੰਦੀ ਕਿ ਉਹਨਾਂ ਨੇ ਪੱਕਾ ਲਿਖਿਆ ਹੋਇਆ ਵੀ ਅਸੀਂ ਨਗਦੀ ਲਵਾਂਗੇ ਬਾਕੀ ਇੰਟਰਨੈਟ ਨੇ ਲੈਣ ਦੇਣ ਦੇ ਸੰਕਲਪ ਨੂੰ ਬਹੁਤ ਬਦਲਿਆ ਬਹੁਤ ਜ਼ਿਆਦਾ ਬਦਲਿਆ ਜੇ ਕਿਸੇ ਨੂੰ ਵੀ ਪੈਸੇ ਦੇਣੇ ਹੁੰਦੇ ਹਾਂ ਤਾਂ ਘਰ ਬੈਠੇ ਦੇ ਦਿੰਦੇ ਹਾਂ ਮਿੰਟੋ ਸਕਿੰਟੀ ਅਗਲੇ ਕੋਲ ਪਹੁੰਚ ਜਾਂਦੇ ਨਹੀਂ ਪਹਿਲਾਂ ਕੀ ਹੁੰਦਾ ਸੀ ਫੜਾਉਣ ਜਾਣਾ ਪੈਂਦਾ ਸੀ ਪਹਿਲਾਂ ਬੈਂਕ 'ਚੋ ਕਢਾਓ ਬੈਂਕ 'ਚੋ ਕਢਾ ਕੇ ਲੈ ਕੇ ਆਓ ਫਿਰ ਜਾ ਕੇ ਬੰਦੇ ਨੂੰ ਦੇ ਕੇ ਆਓ ਕਿੱਥੇ ਹੁਣ ਘਰੇ ਬੈਠੇ ਇੱਕ ਕਲਿੱ ਕਲਿੱਕ ਕੀਤਾ ਮਿੰਟਾਂ ਸਕਿੰਟਾਂ 'ਚ ਬੰਦੇ ਕੋਲ ਪੈਸੇ ਪਹੁੰਚ ਗਏ ਟਾਈਮ ਦੀ ਵੀ ਬੱਚਤ ਹੈ ਅਤੇ ਆਉਣ ਜਾਣ ਦਾ ਖਰਚਾ ਸਾਰਾ ਕੁਛ ਬੱਚਤ ਹੈ ਜਾਣੀ